ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਤਨੂੰ ਕੁਮਾਰੀ ਬੋਲ ਰਹੀ ਹਾਂ ਨਵਾਂਸ਼ਹਿਰ ਤੋਂ ਮੈਂ ਨਾ ਫਲਿੱਪਕਾਰਟ ਤੋਂ ਫੋਨ ਔਡਰ ਕਰਵਾਇਆ ਤਾ ਜਿਹੜਾ ਉਹ ਮੈਨੂੰ ਪਸੰਦ ਨਹੀਂ ਆਇਆ ਕਿਸੇ ਕਾਰਨ ਕਰਕੇ ਤੇ ਹੁਣ ਮੈਂ ਉਹ ਰਿਟਰਨ ਕਰਵਾਇਆ ਤਾ ਅਤੇ ਹੁਣ ਤੱਕ ਮੈਨੂੰ ਉਹਦਾ ਰੀਫੰਡ ਨਹੀਂ ਮਿਲਿਆ ਉਹ ਰਕਮ ਵੀ ਮੈਂ ਦਸ ਹਜ਼ਾਰ ਦਾ ਫੋਨ ਸੀਗਾ ਹੁਣ ਤੱਕ ਮੈਨੂੰ ਉਹਦਾ ਰੀਫੰਡ ਨਹੀਂ ਆਇਆ ਜੇ ਰੀਫੰਡ ਨਹੀਂ ਆਇਆ ਮੈਂ ਆਪਣਾ ਫੋਨ ਵੀ ਲੈਣਾ ਨਵਾਂ ਇਥੋਂ ਆਪਣੇ ਨੇੜੇ ਤੇੜੇ ਹੀ ਕਿਤੇ ਸ਼ੋਪ ਤੋਂ ਲੈ ਲੈਣਾ ਤਾਂ ਬਟ ਹੁਣ ਤੱਕ ਉਹਦਾ ਕੋਈ ਮੈਨੂੰ ਰੀਫੰਡ ਨਹੀਂ ਆਇਆ ਜੇ ਤੁਹਾਨੂੰ ਕੋਈ ਪ੍ਰੋਬਲਮ ਹੈ ਤਾਂ ਮੈਨੂੰ ਦੱਸੋ ਮੈਂ ਤੁਹਾਡੀ ਹੈਲਪ ਕਰ ਦੇਣੀ ਮੈਂ ਆਪਣਾ ਨਵਾਂ ਫੋਨ ਲੈਣਾ ਏ ਮੈਨੂੰ ਲੋੜ ਵੀ ਹੈ ਫਲਿੱਪਕਾਰਟ ਤੋਂ ਹੀ ਔਡਰ ਕਰਵਾਇਆ ਤਾ ਮੈਂ ਤੇ ਉਹਦਾ ਰੀਫੰਡ ਮੈਨੂੰ ਦੱਸ ਦੋ ਕਿ ਕਦੋਂ ਤੱਕ ਮਿਲਣਾ ਕਦੋਂ ਤੱਕ ਨਹੀਂ ਮਿਲਣਾ ਜੇ ਕੋਈ ਹੈਲਪ ਚਾਹੀਦੀ ਆ ਤਾਂ ਮੈਂ ਜ਼ਰੂਰ ਕਰ ਦੇਣੀ